ਮੈਂ ਆਪਣੇ ਘਰ ਤਾਂ ਕੋਈ ਵੀ ਜਾਨਵਰ ਨਹੀਂ ਰੱਖਿਆ ਹੋਇਆ ਪਰ ਮੈਂ ਬਾਹਰ ਵਾਲੇ ਜਾਨਵਰਾਂ ਦੀ ਬਹੁਤ ਹੀ ਦੇਖਭਾਲ ਕਰਦੀ ਹਾਂ ਜੇਕਰ ਮੈਨੂੰ ਕੋਈ ਰਸਤੇ ਵਿੱਚ ਕੁੱਤਾ ਜਾਂ ਬਿੱਲੀ ਜ਼ਖਮੀ ਦਿਖ ਜਾਂਦੇ ਹਨ ਤਾਂ ਮੈਂ ਉਹਨਾਂ ਦੀ ਬਿਲਕੁਲ ਮਦਦ ਕਰਦੀ ਹਾਂ ਉਹਨਾਂ ਦੀ ਸੱਟ 'ਤੇ ਵੀ ਮਲਮ ਪੱਟੀ ਲਗਾ ਦਿੰਦੀ ਹਾਂ ਮੈਨੂੰ ਜਾਨਵਰਾਂ ਦੀ ਦੇਖਭਾਲ ਕਰਨਾ ਬਹੁਤ ਹੀ ਪਸੰਦ ਹੈ ਮੈਂ ਉਹਨਾਂ ਨਾਲ ਬਹੁਤ ਹੀ ਪਿਆਰ ਕਰਦੀ ਹਾਂ ਮੇਰੇ ਕੋਲ ਉਹਨਾਂ ਦੀ ਮਦਦ ਲਈ ਕੋਈ ਵੀ ਲੋਕ ਨਹੀਂ ਹਨ ਜੇਕਰ ਮੈਂ ਉਹਨਾਂ ਨੂੰ ਕਿਸੇ ਵੀ ਮੁਸੀਬਤ ਵਿੱਚ ਦੇਖਦੀ ਹਾਂ ਤਾਂ ਮੈਂ ਉਹਨਾਂ ਨੂੰ ਬਚਾਉਂਦੀ ਵੀ ਹਾਂ ਅਤੇ ਉਹਨਾਂ ਦਾ ਇਲਾਜ ਆਪਣੇ ਇਲਾਕੇ ਦੇ ਹਸਪਤਾਲ ਵਿੱਚ ਕਰਾਉਂਦੀ ਹਾਂ ਆਈਜੀਨ ਦਾ ਧਿਆਨ ਰੱਖਣ ਲਈ ਮੈਂ ਆਪਣੇ ਹੱਥਾਂ ਵਿੱਚ ਜਾਨਵਰਾਂ ਨੂੰ ਦਵਾਈ ਲਗਾਉਣ ਤੋਂ ਬਾਅਦ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਲੈਂਦੀ ਹਾਂ ਜਾਂ ਮੈਂ ਉਹਨਾਂ ਨੂੰ ਆਪਣੇ ਘਰ ਲਿਆ ਲੈ ਆਉਂਦੀ ਹਾਂ ਜਿਸ ਨਾਲ ਕਿ ਮੈਂ ਆਪਣੇ ਹੱਥਾਂ 'ਤੇ ਗਲੱਬਸ ਵਗੈਰਾ ਪਾ ਕੇ ਵੀ ਉਹਨਾਂ ਦਾ ਉਹਨਾਂ ਦੀ ਦੇਖਭਾਲ ਕਰ ਸਕਾਂ ਜਾਨਵਰਾਂ ਦੀ ਦੇਖਭਾਲ ਕਰਨਾ ਮੈਨੂੰ ਬਹੁਤ ਹੀ ਪਸੰਦ ਹੈ ਮੈਂ ਉਹਨਾਂ ਨਾਲ ਹਮੇਸ਼ਾਂ ਪਿਆਰ ਕਰਦੀ ਹਾਂ ਜਾਨਵਰਾਂ ਦੀ ਦੇਖਭਾਲ ਸਾਨੂੰ ਸਭ ਨੂੰ ਕਰਨੀ ਚਾਹੀਦੀ ਹੈ ਅਤੇ ਹਾਈਜੀਨ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ ਹਾਈਜੀਨ ਦਾ ਧਿਆਨ ਰੱਖਣ ਲਈ ਜਾਨਵਰਾਂ ਨੂੰ ਵੀ ਸਾਫ ਸੁਥਰਾ ਕਰਨਾ ਚਾਹੀਦਾ ਹੈ ਜਦੋਂ ਜਾਨਵਰ ਪੂਰੀ ਤਰ੍ਹਾਂ ਠੀਕ ਹੋ ਜਾਂਦੇ ਹਨ ਤਾਂ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਨਹਿਲਾ ਧੁਲਾ ਕੇ ਉਹਨਾਂ ਦੇ ਰਸਤੇ 'ਤੇ ਛੱਡ ਦਿੰਦੀ ਹਾਂ ਜਿਹਨਾਂ ਨਾਲ ਉਹ ਬਹੁਤ ਹੀ ਸ ਸੁਰਕਸ਼ਿਤ ਤਾਂ ਨਹੀਂ ਪਰ ਉਹਨਾਂ ਦੀ ਮਦਦ ਹੋ ਜਾਂਦੀ ਹੈ ਜੇਕਰ ਕੋਈ ਜਾਨਵਰ ਬਹੁਤੀ ਦੇਰ ਲਵਾਉਂਦਾ ਹੈ ਠੀਕ ਹੁੰਦੇ ਤਾਂ ਮੈਂ ਉਹਨਾਂ ਨੂੰ ਜਾਨਵਰਾਂ ਦੇ ਜਿੱਥੇ ਜਾਨਵਰ ਰੱਖੇ ਜਾਂਦੇ ਹਨ ਉੱਥੇ ਛੱਡ ਆਉਂਦੀ ਹਾਂ